ਟੈਕਨੋਲੋਜੀ ਨੇ ਸਾਡੀ ਜ਼ਿੰਦਗੀ ਦੇ ਵਿੱਚ ਇੱਕ ਅਹਿਮ ਭੂਮਿਕਾ ਨਿਭਾਈ ਹੈ ਇਹਨੇ ਸਾਡੀ ਜ਼ਿੰਦਗੀ ਨੂੰ ਬਿਲਕੁਲ ਬਦਲ ਕੇ ਰੱਖ ਦਿੱਤਾ ਹੈ ਜਿਸ ਤਰ੍ਹਾਂ ਸਮਾਰਟ ਫੋਨ ਰਾਹੀਂ ਆਪਾਂ ਇੰਟਰਨੈਟ ਦੀ ਵਰਤੋਂ ਕਰਦੇ ਹਾਂ ਇਹਦੇ ਤੋਂ ਅਸੀਂ ਬੱਚਿਆਂ ਦੀ ਫੀਸ ਦਾ ਭੁਗਤਾਨ ਕਰ ਸਕਦੇ ਹਾਂ ਔਨਲਾਈਨ ਸਿਲੈਡਰ ਬੁੱਕ ਕਰਕੇ ਉਸ ਦਾ ਭੁਗਤਾਨ ਕਰ ਸਕਦੇ ਹਾਂ ਰੇਲਵੇ ਦੀ ਕਿਤੇ ਵੀ ਜਾਣਾ ਹੋਵੇ ਰੇਲਵੇ ਦੀ ਟਿਕਟ ਬੁੱਕ ਕਰ ਸਕਦੇ ਹਾਂ ਹੋਟਲ ਬੁੱਕ ਕਰ ਸਕਦੇ ਹਾਂ ਅਤੇ ਪੈਸਾ ਕਿਸੇ ਵੀ ਜਗ੍ਹਾ 'ਤੇ ਤਾਂ ਆਪਾਂ ਬਾਹਰ ਦੇ ਮੁਲਕ ਵਿੱਚ ਕੋਈ ਰਹਿੰਦਾ ਹੋਵੇ ਉੱਥੋਂ ਵੀ ਪੈਸੇ ਆਪਾਂ ਔਨਲਾਈਨ ਪਵਾ ਸਕਦੇ ਹਾਂ ਟੈਕਨੋਲਜੀ ਦੁਆਰਾ ਬੈਂਕਿੰਗ ਦੇ ਵਿੱਚ ਅਹਿਮ ਭੂਮਿਕਾ ਹੈ ਖਰੀਦਦਾਰੀ ਕਰਨੀ ਹੋਵੇ ਐਮਜੌਨ ਵਗੈਰਾ ਤੋਂ ਕੋਈ ਚੀਜ਼ ਖਰੀਦਣੀ ਹੋਵੇ ਉਹ ਵੀ ਆਪਾਂ ਟੈਕਨੋਲੋਜੀ ਰਾਹੀਂ ਹੀ ਖਰੀਦ ਸਕਦੇ ਹਾਂ ਇਸ ਤੋਂ ਇਲਾਵਾ ਹੋਰ ਵੀ ਬਹੁਤ ਜਿਹੜੀਆਂ ਚੀਜ਼ਾਂ ਵਾ ਜਿਸ ਤਰ੍ਹਾਂ ਕੋਈ ਵੀ ਕਿਸ ਤਰ੍ਹਾਂ ਸ਼ੂਜ਼ ਖਰੀਦਣੇ ਹੋਣ ਜਾਂ ਕੋਈ ਕਿਤੇ ਜਾਣਾ ਹੋਵੇ ਤਾਂ ਆਪਾਂ ਨੂੰ ਜੇਬ ਦੇ ਵਿੱਚ ਪੈਸੇ ਪਾ ਕੇ ਜਾਣ ਦੀ ਜ਼ਰੂਰਤ ਨਹੀਂ ਹੈਗੀ ਆਪਾਂ ਆਪਣਾ ਏ ਟੀ ਐੱਮ ਨਾਲ ਲੈ ਕੇ ਜਾ ਸਕਦੇ ਹਾਂ ਏ ਟੀ ਐੱਮ ਦੇ ਵਿੱਚ ਜਾ ਕੇ ਆਪਾਂ ਜਾਂ ਫੋਨ ਪੇ ਦੁਬਾਰਾ ਆਪਾਂ ਕੋਈ ਚੀਜ਼ ਦੀ ਖਰੀਦਾਰੀ ਕਰਦੇ ਹਾਂ ਤਾਂ ਆਪਾਂ ਉਹਦੇ ਤੋਂ ਪੈਸੇ ਪੇ ਕਰ ਸਕਦੇ ਹਾਂ ਆਪਾਂ ਨੂੰ ਜੇਬ ਵਿੱਚ ਪੈਸੇ ਪਾ ਕੇ ਜਾਣ ਦੀ ਜ਼ਰੂਰਤ ਨਹੀਂ ਹੈਗੀ